ਵੈਸੇ ਤਾਂ ਬਿਜਲੀ ਸਾਡੇ ਸਰਦੀਆਂ ਦੀ ਟਾਈਮ ਤਾਂ ਘੱਟ ਹੀ ਜਾਂਦੀ ਹੈ ਪਰ ਜਦੋਂ ਗਰਮੀਆਂ ਹੁੰਦੀਆਂ ਉਸ ਦਿਨ ਉਸ ਟਾਈਮ ਸਾਡੀ ਬਿਜਲੀ ਬਾਰ੍ਹਾਂ ਬਾਰ੍ਹਾਂ ਘੰਟੇ ਕੱਟ ਲੱਗ ਜਾਂਦੇ ਆ ਅਤੇ ਸਰਦੀਆਂ ਵੀ ਹਰ ਸ਼ਨੀਵਾਰ ਨੂੰ ਬਿਜਲੀ ਦਾ ਕੱਟ ਲੱਗਦਾ ਹੀ ਲੱਗਦਾ ਨੌਂ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਅਤੇ ਵੱਖ ਵੱਖ ਮੌਸਮਾਂ ਦੌਰਾਨ ਜਦੋਂ ਗਰਮੀਆਂ ਹੁੰਦੀਆਂ ਉਸ ਟਾਈਮ ਵੀ ਕੱਟ ਲੱਗਦੇ ਸਰਦੀਆਂ ਵਿੱਚ ਘੱਟ ਕੱਟ ਲੱਗਦੇ ਅਤੇ ਮੀਂਹ ਹਨੇਰੀ ਹੁੰਦੀ ਜਦੋਂ ਹਨੇਰੀ ਦੂਰ ਕਿਤੇ ਹੁੰਦੀ ਆ ਪਰ ਬਿਜਲੀ ਸਾਡੀ ਪਹਿਲਾਂ ਹੀ ਕੱਟ ਜਾਂਦੀ ਅਤੇ ਨਾਲ ਦੇ ਪਿੰਡਾਂ ਵਿੱਚ ਜਦ ਹੀ ਬਿਜਲੀ ਆ ਜਾਂਦੀ ਸਾਡੇ ਚਾਰ ਚਾਰ ਦਿਨ ਨਹੀਂ ਬਿਜਲੀ ਆਉਂਦੀ ਜਿਸ ਨਾਲ ਅਸੀਂ ਬਹੁਤ ਜ਼ਿਆਦਾ ਸਫਰ ਕਰਦੇ ਹਾਂ ਅਤੇ ਸਾਨੂੰ ਬਹੁਤ ਮੁਸ਼ਕਿਲਾਂ ਦਾ ਸ ਸਾਹਮਣਾ ਕਰਨਾ ਪੈਂਦਾ ਜਿਵੇਂ ਹੁਣ ਪਹਿਲਾਂ ਹੜ੍ਹ ਆਏ ਸੀ ਉਸ ਟਾਈਮ ਸਾਡੀ ਹਫਤਾ ਹਫਤਾ ਹਫਤਾ ਨਹੀਂ ਸੀ ਬਿਜਲੀ ਆਈ ਅਤੇ ਅਸੀਂ ਬਹੁਤ ਮੁਸ਼ਕਿਲ ਨਾਲ ਉਹ ਟਾਈਮ ਕੱਢਿਆ ਅਤੇ ਅਸੀਂ ਚ